ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਅੰਕਿਤਾ ਬੋਲ ਰਹੇ ਹੋ ਮੈਨੂੰ ਤੁਹਾਡਾ ਨੰਬਰ ਮੇਰੀ ਦੀਦੀ ਨੇ ਦਿੱਤਾ ਹੈ ਹਾਂਜੀ ਮੈਂ ਨਾ ਨਵਾਂਸ਼ਹਿਰ ਘੁੰਮਣ ਆਉਣਾ ਹੈ ਪਾਰਕ 'ਚ ਹਾਂਜੀ ਉੱਥੇ ਮਤਲਬ ਘੁੰਮਣ ਦੀ ਕੋਈ ਫ਼ੀਸ ਵਗੈਰਾ ਤਾ ਨਹੀਂ ਹੈ ਅੱਛਾ ਕਿਹੜੇ ਕਿਹੜੇ ਪਾਰਕ ਹੈ ਉੱਥੇ ਘੁੰਮਣ ਲਈ ਅੱਛਾ ਉੱਥੇ ਦਾ ਮਤਲਬ ਕਿੱਦਾਂ ਦੀ ਹੈ ਮਤਲਬ ਘੁੰਮਣ ਲਈ ਠੀਕ ਹੈ ਸਭ ਕੁਛ ਉੱਥੇ ਅੱਛਾ ਮੈਂ ਨਾ ਛੇ ਤਰੀਕ ਨੂੰ ਆਉਣਾ ਹੈ ਉੱਥੇ ਅਤੇ ਪੰਜ ਤਰੀਕ ਨੂੰ ਮਤਲਬ ਹੋਟਲ 'ਚ ਹੀ ਰੁੱਕਣਾ ਹੈ ਹਾਂਜੀ ਹਾਂਜੀ ਐਡਰੈਸ ਵਗੈਰਾ ਹਾਂਜੀ ਮੈਂ ਨਾ ਮੈਂ ਵੀ ਆਪਣਾ ਐਡਰੈਸ ਵਗੈਰਾ ਤੁਹਾਨੂੰ ਵੱਅਟਸਅੱਪ 'ਤੇ ਸੈਂਡ ਕਰ ਦਿੰਦੀ ਹਾਂ ਇੱਥੇ ਹੈਗਾ ਹੈ ਹੋਟਲ ਗਲੈਕਸੀ ਵਗੈਰਾ ਹੋਟਲ ਕਾਫ਼ੀ ਹੋਟਲ ਹੈ ਜਿਹੜਾ ਮੈਨੂੰ ਠੀਕ ਲੱਗਿਆ ਹਲੇ ਮੈਂ ਦੇਖ ਲੈਣਾ ਅਤੇ ਮੈਂ ਉੱਥੇ ਰੁੱਕ ਕੇ ਤੁਹਾਨੂੰ ਫ਼ੋਨ ਵਗੈਰਾ ਕਰ ਦੇਣਾ ਇੱਕ ਦਿਨ ਪਹਿਲਾਂ ਕਰ ਦੇਣਾ ਫ਼ੋਨ ਹਾਂਜੀ ਠੀਕ ਹੈ ਜੀ ਫ਼ੋਨ ਮੈਂ ਕਰ ਦੇਣਾ ਤੁਹਾਨੂੰ ਤੁਹਾਡੇ ਬਾਰੇ ਨਾ ਬਹੁਤ ਕੁਛ ਸੁਣਿਆ ਹੈ ਮੈਂ ਤਾਂ ਤੁਹਾਡੇ ਕੋਲ ਫ਼ੋਨ ਕਰਿਆ ਤੁਸੀਂ ਕੀ ਬਹੁਤ ਵਧੀਆ ਗਾਈਡ ਕਰਦੇ ਹੋ ਸਾਰਿਆਂ ਨੂੰ ਹਾਂਜੀ ਤਾਂ ਮੈਂ ਤੁਹਾਨੂੰ ਫ਼ੋਨ ਕਰਿਆ ਚਲੋ ਠੀਕ ਹੈ ਜੀ ਫਿਰ ਮਿਲਕੇ ਗੱਲ ਕਰਦੇ ਓਕੇ ਧੰਨਵਾਦ